ਮੈਂ ਅੱਜ ਇੱਕ ਅਜਿਹਾ ਨਾਵਲ ਪੜ੍ਹਿਆ ਸੀ ਜਿਸ ਦਾ ਨਾਂ ਕਲਾਵਤੀ ਸੀ ਉਹ ਬਹੁਤ ਹੀ ਲਾਇਕ ਅਤੇ ਪੜ੍ਹੀ ਲਿਖੀ ਸੀ ਉਹ ਲੜਕੀ ਤਲਵਾਰ ਬਾਜੀ ਘੌੜ ਸਵਾਰੀ ਆਦਿ ਵੀ ਦੀ ਵੀ ਸਿੱਖਿਆ ਵਿੱਚ ਬਹੁਤ ਨਿਪੁੰਨ ਸੀ ਅਤੇ ਨਾਚ ਵੀ ਬਹੁਤ ਵਧੀਆ ਕਰਦੀ ਸੀ ਉਹ ਹਰ ਇੱਕ ਕੰਮ ਵਿੱਚ ਬੜੀ ਚੁਸਤ ਅਤੇ ਹੁਸ਼ਿਆਰ ਸੀ ਪਰ ਜਿਸ ਸਮੇਂ ਉਸ ਜ਼ਮਾਨੇ ਦੇ ਪੰਡਿਤ ਬਹੁਤ ਹੀ ਖ਼ਰਾਬ ਸਨ ਅਤੇ ਲੋਕ ਦੀ ਸੋਚ ਵੀ ਬਹੁਤ ਬੁਰੀ ਸੀ ਅਤੇ ਕੋਈ ਵੀ ਉਸ ਨੂੰ ਦੇਖ ਨਹੀਂ ਸੀ ਸਿਖਾਉਂਦਾ ਸਾਰੇ ਉਸਨੂੰ ਬੁਰੀ ਨਜ਼ਰ ਨਾ ਦੇਖਦੇ ਸਨ ਕਿਉਂਕਿ ਉਹ ਇੱਕ ਲੜਕੀ ਸੀ ਇਸ ਲਈ ਕੁਝ ਲੋਕ ਅਜਿਹਾ ਚਾਉਂਦੇ ਸਨ ਕਿ ਉਸ ਨੂੰ ਵੇਸ਼ਵਾ ਵਿੱਤੀ ਵਿੱਚ ਧਕੇਲ ਸਕਣ ਕਿਉਂਕਿ ਦੁਨੀਆਂ ਵਿੱਚ ਕੋਈ ਵੀ ਚੰਗੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਨਾ ਹੀ ਕਦੀ ਉਸ ਦੇ ਗੁਣਾਂ ਦੀ ਕਦਰ ਕਰ ਸਕਦਾ ਸੀ ਕਿਉਂਕਿ ਸਭ ਦੀ ਸੋਚ ਬਹੁਤ ਹੀ ਘਟੀਆ ਅਤੇ ਨੀਚ ਹੁੰਦੀ ਸੀ ਇਸ ਕਰਕੇ ਮੈਂ ਜਦੋਂ ਇਹ ਨਾਵਲ ਨੂੰ ਪੜ੍ਹਿਆ ਤਾਂ ਮੈਨੂੰ ਕਲਾਵਤੀ ਦੀ ਇੰਨੀ ਸ਼ਖਸ਼ੀਅਤ ਬਾਰੇ ਸੁਣ ਕੇ ਅਤੇ ਲੋਕਾਂ ਦੀ ਨੀਚ ਸੋਚ ਨੇ ਇਸ ਨਾਵਲ ਨੂੰ ਪੜ੍ਹ ਕੇ ਬਹੁਤ ਹੀ ਜ਼ਿਆਦਾ ਰਵਾਇਆ ਸੀ